ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਨੋਵਲ ਦੀ ਗੱਲ ਕਰਨ ਜਾ ਰਿਹਾ ਹਾਂ ਮੈਂ ਔਨਲਾਈਨ ਇੱਕ ਨੋਵਲ ਮੰਗਵਾਇਆ ਸੀ ਪੂਰਨਮਾਸ਼ੀ ਉਸਦਾ ਨਾਮ ਹੈ ਅਤੇ ਉਹ ਨੋਵਲ ਬਹੁਤ ਵਧੀਆ ਸੀ ਅਤੇ ਉਹਦਾ ਪ੍ਰਿੰਟ ਵੀ ਬਹੁਤ ਵਧੀਆ ਸੀ ਲਿਖਿਆ ਬਹੁਤ ਸੋਹਣੇ ਢੰਗ ਨਾਲ ਹੋਇਆ ਉਹ 'ਚ ਇੱਥੋਂ ਤੱਕ ਕਿ ਅਲੱਗ ਅਲੱਗ ਤਰ੍ਹਾਂ ਦੇ ਕਿੱਤਿਆਂ ਨੂੰ ਵੀ ਦਰਸ਼ਾਇਆ ਗਿਆ ਹੈ ਅਤੇ ਨੋਵਲ ਦਾ ਬੁੱਕਮਾਰਕ ਵੀ ਬਹੁਤ ਵਧੀਆ ਸੀ ਟਾਈਮ ਨਾਲ ਮੇਰੇ ਕੋਲ ਡਿਲੀਵਰੀ ਵੀ ਆਈ ਮੈਂ ਨਿੰਦਾ ਨਹੀਂ ਕਰਦਾ ਪੈਸੇ ਵੀ ਲੈਸ ਕੀਤੇ ਉਹਨਾਂ ਨੇ ਕਿਉਂਕਿ ਕਈ ਬੁੱਕਾਂ ਦੇ ਰੇਟ ਹੀ ਬਹੁਤ ਹਾਈ ਕੀਤੇ ਹੋਏ ਨੇ ਕਈ ਐਪ ਵਾਲਿਆਂ ਨੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਜਿਵੇਂ ਦਿੱਤਾ ਅਤੇ ਮੈਂ ਇਹਨਾਂ ਨੂੰ ਬਹੁਤ ਵਧੀਆ ਫੀਡਬੈਕ ਵੀ ਦਿੱਤਾ ਸੀ ਕਿ ਇਹ ਚੀਜ਼ ਦਾ ਕਿ ਤੁਹਾਡਾ ਹਰ ਵਾਰੀ ਮਟੀਰੀਅਲ ਟਾਈਮ 'ਤੇ ਆਉਂਦਾ ਅਤੇ ਬਹੁਤ ਵਧੀਆ ਆਉਂਦਾ ਜੀ ਅਤੇ ਇਸ ਬੁੱਕ 'ਚੋਂ ਮੈਨੂੰ ਜਾਨਣ ਨੂੰ ਮਿਲਿਆ ਇਹਨਾਂ ਨੇ ਪੁਰਾਣੇ ਕਲਚਰ ਨੂੰ ਵੀ ਦਰਸ਼ਾਇਆ ਪੁਰਾਣੇ ਕਲਚਰ ਨੂੰ ਦਿਖਾਇਆ ਗਿਆ ਕਿਉਂਕਿ ਪੰਜਾਬ ਦਾ ਕਲਚਰ ਲੋਸ ਹੋ ਰਿਹਾ ਸੀ ਇਸ ਬੁੱਕ 'ਚ ਬਹੁਤ ਇਕੱਲੀ ਕਦੀ ਜੱਟਵਾਦ ਸਾਰਾ ਦਿਖਾਇਆ ਗਿਆ ਇਹਦੇ 'ਚ ਕਿਉਂਕਿ ਜੱਟ ਜਿਵੇਂ ਉਹ ਨਹੀਂ ਕਿ ਅੱਜ ਕੱਲ੍ਹ ਵਾਲਾ ਕੀ ਕਿ ਕਿਸਾਨੀ ਜੱਟ ਦਿਖਾਏ ਗਏ ਨੇ ਜੋ ਕਿਸਾਨੀ ਕਰਦੇ ਨੇ ਨਾ ਕਿ ਲੜਦੇ ਨੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਦਰਸ਼ਾਈਆਂ ਗਈਆਂ ਇਹ ਨੋਵਲ ਦਾ ਜਿਹੜਾ ਬਾਹਰੀ ਪ੍ਰਿੰਟ ਸੀ ਉਹ ਵੀ ਬਹੁਤ ਵਧੀਆ ਸੀ ਉਹਨੂੰ ਦੇਖ ਕੇ ਹੀ ਬੰਦਾ ਐਕਸਾਈਟਡ ਹੋ ਜਾਂਦਾ ਕਿ ਇਹ ਚੀਜ਼ ਬਹੁਤ ਵਧੀਆ ਹੋਏਗੀ ਸੋ ਇੰਨਾਂ ਕੁ ਹੀ ਫੀਡਬੈਕ ਮੈਂ ਤੁਹਾਨੂੰ ਦੇ ਰਿਹਾ ਕਿ ਇਹ ਬਹੁਤ ਵਧੀਆ ਚੀਜ਼ ਹੈ ਇਹਨੂੰ ਸਾਰੇ ਜਾਣੇ ਪੜ੍ਹੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ